ਸ਼ਹਿਰਾਂ ਦੇ ਸਕੂਲਾਂ ਦੇ ਮੁਕਾਬਲੇ ਬੇਸ਼ੱਕ ਪਿੰਡਾਂ ਦੇ ਸਕੂਲ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਪਿੱਛ ਪੱਛੜੇ ਹੋਏ ਨੇ ਪਰ ਜੇ ਦੇਖਿਆ ਜਾਵੇ ਅੱਜ ਦੀ ਘੜੀ ਦੇ ਵਿੱਚ ਵੱਧ ਰਹੀ ਡਿਵੈਲਪਮੈਂਟ ਐਜੂਕੇਸ਼ਨ ਦੇ ਕਾਰਣ ਅੱਜ ਦੀ ਘੜੀ ਪਿੰਡਾਂ ਦੇ ਕਸਬਿਆਂ ਦੇ ਸਕੂਲ ਵੀ ਅੱਗੇ ਆ ਰਹੇ ਨੇ ਤਾਂ ਅੱਜ ਦੀ ਘੜੀ ਜੇ ਅਸੀਂ ਸੋਚਦੇ ਹਾਂ ਤਾਂ ਵੀ ਪੰ ਪੰਜਾਬ ਦੇ ਵਿੱਚ ਸ਼ਹਿਰਾਂ ਅਤੇ ਕਸਬਿਆਂ ਦੇ ਸਕੂਲਾਂ ਦੇ ਵਿੱਚ ਕੀ ਵਿਭਿੰਨਤਾ ਤਾਂ ਸਭ ਤੋਂ ਵੱਡੀ ਵਿਭਿੰਨਤਾ ਜੇ ਅਸੀਂ ਪੋਜੀਟਿਵ ਪੁਆਇੰਟ ਵਿੱਚ ਜਾਣਿਆ ਜਾਵੇ ਤਾਂ ਸਾਡੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਫਿਜੀਕਲ ਲੈਵਲ ਜਿਹੜਾ ਬੱਚਿਆਂ ਦਾ ਬਹੁਤ ਵਧੀਆ ਅਤੇ ਉੱਚਾ ਜਿਹਦੇ ਵਿੱਚ ਕਿ ਆ ਕਿ ਸ਼ਹਿਰਾਂ ਦੇ ਮੁਕਾਬਲਿਆਂ ਦੇ ਵਿੱਚ ਜਿਹੜੇ ਸ਼ਹਿਰ ਨੇ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਬੱਚੇ ਨੇ ਉਹ ਬੱਚੇ ਉੰਨੀ ਗਰੋਥ ਨਹੀਂ ਕਰ ਪਾਉਂਦੇ ਜਿੰਨਾ ਕਿ ਪਿੰਡਾਂ ਦੇ ਸਕੂਲਾਂ ਦੇ ਵਿੱਚ ਫਿਜੀਕਲ ਦੇ ਕੰਨੀ ਧਿਆਨ ਦੇ ਕੇ ਜਾਂ ਕੰਮ ਕਾਰ ਦੇ ਵਿੱਚ ਵਧੇ ਹੋਣ ਦਾ ਕਰਕੇ ਫਿਜੀਕਲ ਦੇ ਵਿੱਚ ਵਧੇ ਨੇ ਪਰ ਜੇ ਦੇਖਿਆ ਜਾਵੇ ਐਜੂਕੇਸ਼ਨ ਪੱਖ ਤੋਂ ਕਸਬਿਆਂ ਦੇ ਜਿਹੜੇ ਲੋਕ ਨੇ ਉਹ ਘੱਟ ਜਾਗਰੁਕ ਹੋਣ ਦਾ ਕਰਕੇ ਜਿਹੜੇ ਪਿੱਛੇ ਰਹਿਣ ਲੱਗ ਗਏ ਨੇ ਪਰ ਵਧਦੇ ਐਜੂਕੇਸ਼ਨ ਦੇ ਸਿਸਟਮ ਦੇ ਕਾਰਣ ਅੱਜ ਦੀ ਘੜੀ ਦੇਖਿਆ ਜਾਵੇ ਤਾਂ ਪਿੰਡਾਂ ਦੇ ਸਕੂਲਾਂ ਨੇ ਵੀ ਬੜੀਆਂ ਮੱਲਾਂ ਮਾਰੀਆਂ ਨੇ ਹੁਣ ਦੇ ਨਤੀਜਿਆਂ ਦੇ ਅਨੁਸਾਰ ਬਹੁਤ ਸਾਰੇ ਬੱਚਿਆਂ ਨੇ ਪੰਜਾਬ ਦੇ ਵਿੱਚੋਂ ਇੰਡੀਆ ਲੈਵਲ ਤੱਕ ਵੀ ਤਗਮੇ ਖੱਟੇ ਨੇ ਤਾਂ ਜੋ ਸ਼ਹਿਰਾਂ ਦੇ ਸਕੂਲ ਨੇ ਬਸ ਉੱਥੋਂ ਦੇ ਅਸੀਂ ਐਵੇਂ ਆਖ ਸਕਦੇ ਹਾਂ ਵੀ ਉਹਨਾਂ ਦੇ ਮਾਪੇ ਡਿਵੈਲਪ ਹੋਣ ਦਾ ਕਰਕੇ ਜਿਹੜੇ ਨੇ ਉਹ ਜ਼ਿਆਦਾ ਵਧੀਆ ਨੇ ਉੱਥੋਂ ਦੇ ਲੋਕ ਜਾਗਰੂਕ ਨੇ ਅਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਕਸਬਿਆਂ ਦੇ ਲੋਕ ਨੇ ਉਹਨਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਸੋ ਅਸੀਂ ਸੋਚ ਸਕਦੇ ਹਾਂ ਅਸੀਂ ਵੀ ਆਪਣੀ ਸੋਚ ਨੂੰ ਬਦਲ ਕੇ ਪਿੰਡਾਂ ਦੇ ਸਕੂਲਾਂ ਦੇ ਐਜੂਕੇਸ਼ਨ ਦੇ ਵੱਲ ਕਸਬਿਆਂ ਦੀ ਐਜੂਕੇਸ਼ਨ ਦੇ ਵੱਲ ਅਸੀਂ ਧਿਆਨ ਦੇ ਕੇ ਉਸਨੂੰ ਵਧੀਆ ਹੋਰ ਵਧੀਆ ਬਣਾ ਸਕਦੇ ਹਾਂ ਅਤੇ ਸ਼ਹਿਰਾਂ ਦੇ ਮੁਕਾਬਲੇ ਦੇ ਵਿੱਚ ਟੱਕਰ ਦੇ ਸਕਦੇ ਹਾਂ ਸੋ ਇਹਨਾਂ ਸ਼ਬਦਾਂ ਨਾਲ ਮੈਂ ਧੰਨਵਾਦ ਕਰਦਾ